ਲੋਕ ਵਿਆਹ 'ਤੇ ਲਾੜੀ ਨੂੰ ਦਾਜ ਜਾਂ ਤੋਹਫ਼ੇ ਦੇਣ ਦੀ ਪ੍ਰਥਾ ਦਾ ਵੈਸੇ ਪੂਰੇ ਭਾਰਤ ਵਿੱਚ ਹੀ ਪ੍ਰਚਲਿਤ ਹੈ ਪਰ ਇਸ ਪ੍ਰਥਾ ਦਾ ਜ਼ਿਆਦਾ ਪ੍ਰਚਾਰ ਪ੍ਰਸਾਰ ਉੱਤਰ ਭਾਰਤ ਵਿੱਚ ਕੀਤਾ ਜਾਂਦਾ ਹੈ ਉੱਤਰ ਭਾਰਤ ਵਿੱਚ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਖ਼ਾਸ ਕਰਕੇ ਪੰਜਾਬ ਅਤੇ ਹਰਿਆਣਾ ਵਿੱਚ ਇਸ ਪ੍ਰਥਾ ਦਾ ਜ਼ਿਆਦਾ ਪ੍ਰਚਲਨ ਹੈ ਇਸ ਪ੍ਰਥਾ ਵਿੱਚ ਲਾੜੀ ਦੇ ਮਾਪਿਆਂ ਵੱਲੋਂ ਲਾੜੀ ਨੂੰ ਕੁਝ ਤੋਹਫ਼ੇ ਦਿੱਤੇ ਜਾਂਦੇ ਹਨ ਉਹ ਤੋਹਫ਼ੇ ਕੁਛ ਕੁਛ ਵੀ ਤਰ੍ਹਾਂ ਦੇ ਹੋ ਸਕਦੇ ਹਨ ਜਿਵੇਂ ਕਿ ਫਰਨੀਚਰ ਹੋ ਗਿਆ ਕੋਈ ਸੋਨਾ ਚਾਂਦੀ ਗਹਿਣੇ ਹੋ ਗਏ ਜਮੀਨ ਜਾਇਦਾਦ ਇਹ ਇਹ ਸਭ ਦਿੱਤਾ ਜਾਂਦਾ ਹੈ ਇਹ ਸਭ ਦੇਣ ਲਈ ਲਾੜੀ ਦੇ ਮਾਪਿਆਂ ਵੱਲੋਂ ਕਈ ਵਾਰੀ ਕਰਜ਼ਾ ਵੀ ਲਿੱਤਾ ਜਾਂਦਾ ਹੈ ਤਾਂ ਤਾਂ ਜੋ ਦੇਖਿਆ ਜਾਵੇ ਤਾਂ ਹੀ ਇਹ ਪ੍ਰਥਾ ਇੱਕ ਗਲਤ ਪ੍ਰਥਾ ਹੈ ਇਸ ਪ੍ਰਥਾ ਨਾਲ ਲਾੜੀ ਦੇ ਮਾਪਿਆਂ ਉੱਪਰ ਫਾਲਤੂ ਦਾ ਬੋਝ ਪੈਂਦਾ ਹੈ ਤਾਂ ਉਹ ਕਰਜ਼ਾ ਲੈਣ ਵਾਸਤੇ ਮਜਬੂਰ ਹੋ ਜਾਂਦੇ ਹਨ ਇਹ ਕਰਜ਼ਾ ਕਰਜ਼ਾ ਲੈਣ ਵਾਸਤੇ ਫਿਰ ਉਹਨਾਂ ਨੂੰ ਉਤਾਰਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਇਹ ਇਹ ਪ੍ਰਥਾ ਦੇ ਬਾਵਜੂਦ ਵੀ ਆਪਾਂ ਕਹਿ ਨਹੀਂ ਸਕਦੇ ਕਿ ਕੁੜੀ ਅੱਗੇ ਜਾ ਕੇ ਇਹ ਖੁਸ਼ ਹੀ ਰਹੇਗੀ ਕਈ ਵਾਰੀ ਫਿਰ ਵੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕਿਉਂਕਿ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਇਸ ਪ੍ਰਥਾ ਨੂੰ ਥੋੜ੍ਹਾ ਅ ਇਸ ਇਸ ਪ੍ਰਥਾ ਪ੍ਰਥਾ ਬਾਰੇ ਥੋੜ੍ਹਾ ਜਿਹਾ ਪ੍ਰਚਾਰ ਪ੍ਰਸਾਰ ਕਰਨਾ ਜ਼ਰੂਰੀ ਹੈ ਤਾਂ ਜੋ ਇਸ ਪ੍ਰਥਾ ਨੂੰ ਖ਼ਤਮ ਕੀਤਾ ਜਾਵੇ ਵੈਸੇ ਤਾਂ ਇਸ ਪ੍ਰਥਾ ਬਾਰੇ ਅ ਕਾਨੂੰਨ ਵੀ ਬਣੇ ਹੋਏ ਹਨ ਪਰ ਕਾਨੂੰਨ ਦੀ ਕਾਨੂੰਨ ਬਾਰੇ ਜ਼ਿਆਦਾ ਨਾ ਪਤਾ ਹੋਣ ਕਰਕੇ ਲਾੜੀ ਦੇ ਮਾਪਿਆਂ ਵੱਲੋਂ ਇਸ ਪ੍ਰਥਾ ਨੂੰ ਹਜੇ ਤੱਕ ਚਲਾਇਆ ਜਾ ਰਿਹਾ ਹੈ ਅਤੇ ਲੋਕ ਸਮਾਜ ਵੀ ਇਸ ਦੇ ਲਈ ਜ਼ਿੰਮੇਵਾਰ ਹੈ ਕਿਉਂਕਿ ਅਮੀਰ ਲੋਕ ਤਾਂ ਬਹੁਤ ਆਸਾਨੀ ਨਾਲ ਆਪਣੇ ਆਪਣੀ ਕੁੜੀ ਨੂੰ ਸਭ ਕੁਝ ਦੇ ਸਭ ਕੁਝ ਦ ਦਾਜ ਵਿੱਚ ਦੇ ਦਿੰਦੇ ਹਨ ਪਰ ਇਹ ਪ੍ਰਥਾ ਗਰੀਬ ਲੋਕਾਂ ਗਰੀਬ ਲੋਕਾਂ ਲਈ ਬਹੁਤ ਬਹੁਤ ਬਹੁਤ ਗਰੀਬ ਲੋਕਾਂ ਉੱਪਰ ਬਹੁਤ ਬੋਝ ਬਣਦੀ ਹੈ ਜਿਸ ਕਰਕੇ ਇਸ ਪ੍ਰਥਾ ਨੂੰ ਖ਼ਤਮ ਕਰਨਾ ਚਾਹੀਦਾ ਹੈ